ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਭਰਾਵਾਂ ਦੇ ਢਾਬੇ ਤੋਂ ਗੱਲ ਕਰ ਰਹੇ ਹੋ ਅਸੀਂ ਅੰਮ੍ਰਿਤਸਰ ਤੋਂ ਗੱਲ ਕਰ ਰਹੇ ਸੀ ਅਸੀਂ ਪਰਿਵਾਰ ਸਮੇਤ ਸ਼ਾਮ ਦਾ ਖਾਣਾ ਤੁਹਾਡੇ ਕੋਲ ਖਾਣਾ ਚਾਹੁੰਦੇ ਸੀ ਅਸੀਂ ਜਾਣਨਾ ਚਾਹੁੰਦੇ ਸੀ ਕਿ ਤੁਸੀਂ ਸ਼ਾਮ ਦੇ ਖਾਣੇ ਦੇ ਵਿੱਚ ਕੀ ਕੀ ਤਿਆਰ ਕਰਦੇ ਹੋ ਸਾਡੇ ਪਰਿਵਾਰਕ ਮੈਂਬਰ ਸ਼ਾਹੀ ਪਨੀਰ ਕਾਬੁਲੀ ਛੋਲੇ ਅਤੇ ਭਿੰਡੀ ਕਰੇਲਾ ਵਗੈਰਾ ਖਾਣਾ ਪਸੰਦ ਕਰਦੇ ਨੇ ਤੁਸੀਂ ਇਹੋ ਜਿਹੀ ਕੋਈ ਆਈਟਮ ਸ਼ਾਮ ਨੂੰ ਖਾਣੇ ਵਿੱਚ ਤਿਆਰ ਕਰਦੇ ਹੋ ਅਤੇ ਮਿੱਠੇ ਦੇ ਵਿੱਚ ਤੁਸੀਂ ਕੀ ਤਿਆਰ ਕਰਦੇ ਹੋ ਮਿੱਠੇ ਦੇ ਵਿੱਚ ਖੀਰ ਬਣਾਉਂਦੇ ਹੋ ਗੁਲਾਬ ਜਾਮੁਣ ਹੋ ਜਾਣ ਜਾਂ ਕੋਈ ਜਲੇਬੀ ਵਗੈਰਾ ਸ਼ਾਮ ਦੇ ਖਾਣੇ ਵਿੱਚ ਤਿਆਰ ਕਰਦੇ ਹੋ ਸਾਡੇ ਪਰਿਵਾਰਕ ਮੈਂਬਰ ਸ਼ਾਮ ਦੇ ਖਾਣੇ ਵਿੱਚ ਮਿੱਠੇ ਦੇ ਨਾਲ਼ ਵੀ ਕੋਈ ਨਾ ਕੋਈ ਚੀਜ਼ ਜ਼ਰੂਰ ਲੈਂਦੇ ਨੇ ਇਸ ਲਈ ਮੈਂ ਤੁਹਾਨੂੰ ਫ਼ੋਨ ਕਰ ਰਿਹਾ ਸੀ ਕਿ ਤੁਸੀਂ ਕੋਈ ਵਧੀਆ ਸ਼ਾਮ ਦੇ ਖਾਣੇ ਦੇ ਵਿੱਚ ਸਾਨੂੰ ਮਿੱਠੇ ਵਾਲੀ ਚੀਜ਼ ਵੀ ਦੇਣੀ ਹੈ ਅਤੇ ਨਾਲ਼ ਮਸਾਲੇਦਾਰ ਕੋਈ ਆਈਟਮ ਭਿੰਡੀ ਕੋਈ ਕਰੇਲਾ ਜਾਂ ਕੋਈ ਵਧੀਆ ਬਤਾਊਂ ਦੀ ਸਬਜ਼ੀ ਹੋ ਜਾਵੇ ਉਹ ਤੁਸੀਂ ਜ਼ਰੂਰ ਬਣਾਉਣੀ ਹੈ ਅਸੀਂ ਪਰਿਵਾਰ ਸਮੇਤ ਤੁਹਾਡੇ ਕੋਲ ਜ਼ਰੂਰ ਆਵਾਂਗੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ